ਹੈਲੋ ਹੈਲੋ ਹਾਂਜੀ ਸਰ ਕਿਵੇਂ ਹੋ ਕੀ ਹਾਲ ਚਾਲ ਨੇ ਵਧੀਆ ਵਧੀਆ ਜੀ ਤੁਸੀਂ ਸੁਣਾਓ ਸਰ ਪਛਾਣਿਆ ਮੈਂ ਕੌਣ ਬੋਲਦਾ ਜੀ ਮੈਂ ਗੁਰਕਵਲ ਜੋਤ ਸਿੰਘ ਬੋਲ ਰਿਹਾ ਜੀ ਓਹ ਮੈਂ ਐਕਟਰ ਥੋੜ੍ਹਾ ਜਿਹਾ ਮੇਰੇ ਵਾਸਤੇ ਕੋਈ ਐਕਟਿੰਗ ਉਕਟਿੰਗ ਹੈਗੀ ਤੁਹਾਡੇ ਕੋਲ ਇਹ ਪੁੱਛਣਾ ਸੀ ਮੈਂ ਮੈਂ ਕੁਛ ਜਿਹੜੇ ਗਾਣਿਆਂ ਦੇ ਵਿੱਚ ਸ਼ੂਟ ਕੀਤੇ ਨੇ ਥੋੜ੍ਹੇ ਬਹੁਤੇ ਰੋਲ ਪਲੇ ਕੀਤਾ ਵਾ ਥੋੜ੍ਹਾ ਬਹੁਤਾ ਜਿਵੇਂ ਕਿ ਸਿੱਧੂ ਮੂਸੇਵਾਲਾ ਦਾ ਉਹ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉਹਦੇ ਵਿੱਚ ਕੀਤਾ ਸੀ ਤੁਸੀਂ ਦੇਖ ਹੀ ਸਕਦੇ ਹੋ ਉਹ 'ਚ ਹਾਂਜੀ ਹਾਂਜੀ ਅਤੇ ਇੱਕ ਉਹਦੇ ਵਿੱਚ ਕੀਤਾ ਜੀ ਮੈਂ ਆਪਣੇ ਕਰਨ ਔਜਲਾ ਦੇ ਬੇਬੀ ਗਾਣੇ 'ਚ ਹਾਂਜੀ ਹਾਂਜੀ ਹਾਂਜੀ ਫਿਲਮਾਂ 'ਚ ਵੀ ਕਰ ਮਾੜਾ ਮੋਟੀ ਇੱਕ ਅੱਧੀ ਫਿਲਮ 'ਚ ਕੀਤਾ ਆ ਜੀ ਐਕਟਿੰਗ ਮੈਂ ਉਹਦੇ ਵਾਲੀ 'ਚ ਕੀਤਾ ਸੀਗਾ ਜਿਉਣੇ ਮੋੜ ਵਾਲੀ 'ਚ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਪਛਾਣ ਲਿਆ ਜੀ ਪਛਾਣ ਲਿਆ ਹੋਰ ਸੁਣਾਓ ਜੀ ਹਾਂਜੀ ਹਾਂਜੀ ਚਲੋ ਬਈ ਕੋਈ ਨਹੀਂ ਕਿੱਥੇ ਹੋ ਤੁਸੀਂ ਇਸ ਟਾਈਮ ਹੁਣ ਅੱਛਾ ਜੀ ਮੈਂ ਜੀ ਇੱਧਰ ਆਪਣਾ ਕੰਮ ਜਿਹਾ ਮੈਂ ਕਿਹਾ ਕੰਮ ਜਿਹਾ ਕਰਾਉਂਦਾ ਹੈਲੋ ਲੁਧਿਆਣੇ ਕਿੰਨੇ ਕੰਮ ਕਰਾਉਂਦਾ ਫਿਰਦਾ ਸੀਗਾ ਆਪਦਾ ਉਹ ਥੋੜ੍ਹੇ ਬਹੁਤੇ ਕੀ ਨਾਮ ਕੀ ਹੈ ਜੀ ਆਪਾਂ ਜਿਹੜੀ ਨਵੀਂ ਮੂਵੀ ਬਣਾਉਣੀ ਆ ਅੱਛਾ ਜੀ ਕੋਈ ਕੀ ਕਾਹਦੀ ਐਕਟਿੰਗ ਕਰਨੀ ਜੀ ਮੈਂ ਅੱਛਾ ਜੀ ਅੱਛਾ ਜੀ ਧੰਨਵਾਦ ਜੀ ਤੁਹਾਨੂੰ ਮੇਰੀ ਐਕਟਿੰਗ ਪਸੰਦ ਆਈ ਹੋਰ ਹਾਂਜੀ ਹਾਂਜੀ ਕਲਾਕਾਰੀ ਤਾਂ ਮੇਰੀ ਹੀ ਹੈ ਉਹ ਤਾਂ ਰੱਬ ਦੀ ਦੇਣ ਆ ਜੀ ਉਹ ਤਾਂ ਰੱਬ ਦੀ ਦੇਣ ਆ ਜੀ ਜਿਵੇਂ ਰੱਬ ਨੇ ਮੈਨੂੰ ਬਖ਼ਸ਼ਿਆ ਹੋਰ ਘਰੇ ਸਾਰੇ ਠੀਕ ਠਾਕ ਨੇ ਜੀ ਤੁਹਾਡੇ ਅੱਛਾ ਜੀ ਮੈਂ ਇਸ ਟਾਈਮ ਜੀ ਲੁਧਿਆਣੇ 'ਚ ਸੀਗਾ ਅੱਛਾ ਜੀ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜ਼ਰੂਰ ਕਰਾਂਗੇ ਤੁਹਾਡੇ ਨਾਲ ਜ਼ਰੂਰ ਕਲੈਬ ਕਰਾਂਗੇ ਆਪਾਂ ਤੁਹਾਡੇ ਨਾਲ ਹਾਂਜੀ ਹਾਂਜੀ ਹਾਂਜੀ ਮੈਂ ਕਹਿੰਦਾ ਸੋਨਮ ਬਾਜਵਾ ਲੈ ਲੈਂਦੇ ਹਾਂ ਜੀ ਇਹ ਬਜਟ ਜ਼ਿਆਦਾ ਅੱਛਾ ਜੀ ਚਲੋ ਕੋਈ ਨਹੀਂ ਠੀਕ ਹੈ ਜੀ ਚਲੋ ਮੇਰਾ ਵੀ ਕੋਈ ਲਿਹਾਜ਼ ਲਿਹੁਜ ਰੱਖ ਲਿਓ ਜੀ ਮੇਰੀ ਪੇਮੈਂਟ ਦਾ

ਠੀਕ ਆ ਜੀ ਫਿਰ ਮਿਲਦੇ ਆ ਆਪਾਂ ਲੁਧਿਆਣੇ ਹਾਂਜੀ ਹਾਂਜੀ ਉੱਥੇ ਹੀ ਖੜ੍ਹਾ ਸੀ ਕਦੋਂ ਕੁ ਆਓਗੇ ਤੁਸੀਂ ਕਿੰਨੇ ਕੁ ਦਿਨ ਲੱਗ ਜਾਣਗੇ ਜੀ ਚਲੋ ਠੀਕ ਜੀ ਮਿਲਦੇ ਆ ਫਿਰ ਆਪਾਂ ਓਕੇ ਓਕੇ ਓਕੇ ਮਿਲਦੇ